ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਲੋਕ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਨੋਂ ਪ੍ਰਕਾਰ ਦਾ ਭੋਜਨ ਖਾਂਦੇ ਹਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਭੋਜਨ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਹੈ ਇਸ ਦੇ ਨਾਲ ਹੀ ਪੰਜਾਬ ਦੀ ਲੱਸੀ ਵੀ ਬਹੁਤ ਮਸ਼ਹੂਰ ਹੈ ਇੱਥੇ ਮਸਾਲੇਦਾਰ ਲੱਸੀ ਅਤੇ ਮਿੱਠੀ ਲੱਸੀ ਮਿਲ ਜਾਂਦੀ ਹੈ ਪੰਜਾਬ ਦੇ ਵਿੱਚ ਛੋਲੇ ਭਟੂਰੇ ਕੁਲਚੇ ਛੋਲੇ ਚਾਟ ਪਾਪੜੀ ਸਮੋਸੇ ਪਕੌੜੇ ਹਰ ਜਗ੍ਹਾ ਮਿਲ ਜਾਂਦੇ ਹਨ ਅੰਮ੍ਰਿਤਸਰ ਦੇ ਕੁਲਚੇ ਛੋਲੇ ਅਤੇ ਪਾਪੜ ਬਹੁਤ ਹੀ ਮਸ਼ਹੂਰ ਹਨ ਜੇਕਰ ਮਾਸਾਹਾਰੀ ਖਾਣੇ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਰੜਾ ਚਿਕਨ ਤੰਦੂਰੀ ਚਿਕਨ ਕੜਾਹੀ ਚਿਕਨ ਬਹੁਤ ਹੀ ਪ੍ਰਸਿੱਧ ਹਨ ਕੋਟਕਪੁਰੇ ਦਾ ਢੋਡਾ ਬਹੁਤ ਹੀ ਸਵਾਦ ਹੁੰਦਾ ਹੈ ਕੁਝ ਅਜਿਹੇ ਪਕਵਾਨ ਵੀ ਹਨ ਜਿਹੜੇ ਕਿ ਕੁਝ ਖਾਸ ਮੌਕਿਆਂ ਅਤੇ ਤਿਉਹਾਰਾਂ 'ਤੇ ਬਣਾਏ ਜਾਂਦੇ ਹਨ ਜਿਵੇਂ ਕਿ ਗੁਲਗੁਲੇ ਅਤੇ ਮਾਲਪੂੜੇ ਇਹ ਖਾਣ ਦੇ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ ਸੈਲਾਨੀਆਂ ਨੂੰ ਇੱਥੇ ਆ ਕੇ ਇਹਨਾਂ ਦਾ ਆਨੰਦ ਲੈਣਾ ਚਾਹੀਦਾ ਹੈ ਇਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਧੰਨਵਾਦ ਜੀ